ਅੱਜ ਕੱਲ੍ਹ ਜਿਹੜਾ ਵਿਗਿਆਪਨ ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿੱਚ ਜਿਹੜੇ ਪਹੁੰਚਣ ਦਾ ਤਰੀਕਾ ਕਈ ਸਾਰੇ ਤਰੀਕੇ ਹੈ ਤੁਸੀਂ ਅਖਬਾਰ ਦੇ ਰਾਹੀਂ ਆਪਣਾ ਜਿਹੜਾ ਹੈ ਆਪਣਾ ਕੋਈ ਵਿਗਿਆਪਨ ਦੇ ਸਕਦੇ ਹੋ ਟੀ ਵੀ ਚੈਨਲ ਰਾਹੀਂ ਦੇ ਸਕਦੇ ਹੋ ਕੋਈ ਲੀਫਲੈਟ ਛਪਵਾ ਕੇ ਉਹ ਜਗ੍ਹਾ ਜਗ੍ਹਾ ਦੀਵਾਰਾਂ 'ਤੇ ਪੇਸਟ ਕਰ ਸਕਦੇ ਹੋ ਜਾਂ ਫਿਰ ਹੋਰ ਵੀ ਜਿਹੜੇ ਲੋਕਾਂ ਨੇ ਇੱਕ ਸਟਾਰਟ ਕੀਤਾ ਕਿ ਮੀਟਿੰਗਜ਼ ਕਰਦੇ ਹੈ ਲੋਕਾਂ ਨੂੰ ਬੁਲਾਉਂਦੇ ਆ ਚਾਹ ਪਾਣੀ 'ਤੇ ਅਤੇ ਉਹਦੇ ਵਿੱਚ ਜਿਹੜਾ ਵੀ ਕੋਈ ਚੀਜ਼ ਆਪਣੀ ਹੈ ਜਿਹੜੀ ਉਹ ਵਰਤੋਂ ਦੀ ਹੈ ਉਹ ਦੱਸਦੇ ਹੈ ਉਹਦੀ ਉਹਦੇ ਬਾਰੇ ਦੱਸਦੇ ਹੈ